ਸਾਡੇ ਜ਼ਿਲ੍ਹੇ ਬਗਤ ਸਿੰਘ ਨਗਰ ਵਿੱਚ ਕਈ ਤਰ੍ਹਾਂ ਦੀ ਸਰਕਾਰ ਵੱਲੋਂ ਸੇਵਾਵਾਂ ਦਿੱਤੀਆਂ ਜਾਂਦੀਆ ਹਨ ਨਸ਼ਾ ਮੁਕਤ ਕੇਂਦਰ ਜਿਸ ਵਿੱਚ ਨਸ਼ਾ ਬਾਰੇ ਬਤਾਇਆ ਜਾਂਦਾ ਦੱਸਿਆ ਜਾਂਦਾ ਹੈ ਕਿ ਨਸ਼ਾ ਬਾ ਨਸ਼ਾ ਨਾਲ਼ ਬਹੁਤ ਸਾਰਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਨਸ਼ਾ ਕਰਕੇ ਇਨਸਾਨ ਦੀ ਸਿਹਤ ਬਿਲਕੁਲ ਵੀ ਠੀਕ ਨਹੀਂ ਰਹਿੰਦੀ ਜਿਸ ਕਰਕੇ ਉਹ ਉਸਦੀ ਤਬੀਅਤ ਜਲਦੀ ਖ਼ਰਾਬ ਹੋ ਜਾਂਦੀ ਅਤੇ ਉਹ ਉਨ੍ਹਾਂ ਦੇ ਘਰ ਵਿੱਚ ਵੀ ਉਨ੍ਹਾਂ ਬਿਮਾਰੀਆਂ ਦਾ ਪ੍ਰੇਸ਼ਾਨੀਆਂ ਨੂੰ ਸਹਿਣ ਕਰਨਾ ਪੈਂਦਾ ਹੈ ਅਤੇ ਸਰਕਾਰ ਨੇ ਜਿੱਦਾਂ ਸਰਕਾਰ ਨੇ ਓਲਡ ਹੋਮ ਵੀ ਬਣਾਇਆ ਹੈ ਜਿਹਦੇ ਕਰ ਜਿਹਦੇ ਅੱਗੇ ਪਿੱਛੇ ਕੋਈ ਨਾ ਹੋਵੇ ਤਾਂ ਉਹ ਉਸ ਓਲਡ ਹੋਮ ਵਿੱਚ ਰਹਿ ਸਕਦਾ ਹੈ ਅਤੇ ਉਹਨਾਂ ਨੂੰ ਉੱਥੇ ਪੂਰੀ ਸੇਵਾਵਾਂ ਦਿੱਤੀਆ ਜਾਂਦੀਆ ਨੇ ਉਹਨਾਂ ਨੂੰ ਪੂਰੇ ਉੱਥੇ ਲਾਭ ਮਿਲਦਾ ਉਹਨੂੰ ਖਾਣਾ ਫਰੀ ਰਹਿਣਾ ਫਰੀ ਹਰ ਕੁਝ ਫਰੀ ਮਿਲਦਾ ਹੈ ਉੱਥੇ